ਬੈਂਕਾਂ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਹਨ ਜਿਨ੍ਹਾਂ ਤੋਂ ਲੋਕ ਪੈਸਾ ਜਾਂ ਕਰਜ਼ਾ ਲੈ ਸਕਦੇ ਹਨ ਲੋਕ ਉਧਾਰ ਸੁਧਾਰ ਕਰ ਲੈਂਦੇ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਲੋਕਾਂ ਨੇ ਆੜਤੀਏ ਬਣਾਏ ਹੋਏ ਹਨ ਆੜਤੀਏ ਤੋਂ ਲੋਕ ਜਿੰਨੇ ਮਰਜ਼ੀ ਪੈਸੇ ਚੁੱਕ ਸਕਦੇ ਹਨ ਕਰਜ਼ੇ ਦੇ ਤੌਰ 'ਤੇ ਹੱਥ ਉਧਾਰ ਸੁਧਾਰ ਵੀ ਕਰ ਸਕਦੇ ਹਨ ਲੋਕ ਆਪਣੀ ਜਿਨਸ ਸੁੱਟ ਦੇ ਹਨ ਅਤੇ ਆੜਤੀਏ ਉਹਨਾਂ ਨੂੰ ਪੈਸੇ ਦਿੰਦੇ ਹਨ ਤੇ ਲੋੜ ਵੇਲੇ ਉਹ ਜਿੰਨੇ ਮਰਜ਼ੀ ਪੈਸੇ ਆੜਤੀਆਂ ਤੋਂ ਲੈ ਸਕਦੇ ਹਨ ਏਜੰਟ ਬਣੇ ਹੋਏ ਹਨ ਇਸ ਤਰ੍ਹਾਂ ਇਸ ਤੋਂ ਇਲਾਵਾ ਸੁਨਿਆਰਿਆਂ ਤੋਂ ਆਪਾਂ ਕਰਜ਼ਾ ਲੈ ਸਕਦੇ ਹਾਂ ਆਪਾਂ ਆਪਣੀ ਕੋਈ ਵੀ ਚੀਜ਼ ਗਿਰਵੀ ਰੱਖ ਸ ਤੇ ਸੁਨਿਆਰਿਆਂ ਤੋਂ ਕਰਜ਼ਾ ਲੈਂਦੇ ਹਾਂ ਇਸ ਤੋਂ ਇਲਾਵਾ ਵਿਅਕਤੀਗਤ ਉਧਾਰ ਬਣਿਆ ਹੋਇਆ ਹੈ ਆਪਾਂ ਰਿਸ਼ਤੇਦਾਰਾਂ ਕੋਲੋਂ ਪੈਸੇ ਲੈ ਸਕਦੇ ਹਾਂ ਲੋੜ ਪੈਣ 'ਤੇ ਕਿਸੇ ਕੋਲੋਂ ਕਰਜ਼ਾ ਲੈ ਸਕਦੇ ਹਾਂ ਵਿਆਜ਼ ਦੇ ਤੌਰ 'ਤੇ ਜਾਂ ਇਸ ਤੋਂ ਇਲਾਵਾ ਆਪਣਾ ਕੋਈ ਰਿਸ਼ਤੇਦਾਰ ਹੈ ਨੇੜਲਾ ਤਾਂ ਆਪਾਂ ਉਹਦੇ ਕੋਲੋਂ ਉਧਾਰ ਸੁਧਾਰ ਲੈ ਸਕਦੇ ਹਾਂ ਇਸ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਹਨ ਬੈਂਕਾਂ ਤੋਂ ਇਲਾਵਾ ਜਿਨ੍ਹਾਂ ਤੋਂ ਆਪਾਂ ਕਰਜ਼ਾ ਲੈ ਕ ਸਕਦੇ ਹਾਂ